ਗੱਲ ਕਰੀਏ ਰੂਪਨਗਰ ਜ਼ਿਲ੍ਹੇ ਦੇ ਵਿੱਚ ਕਾਫੀ ਸਾਰਾ ਸੁਧਾਰ ਆਇਆ ਆਉਣ ਵਾਲੇ ਟਾਈਮ ਦੇ ਵਿੱਚ ਹੋ ਵੀ ਰਿਹਾ ਅਤੇ ਕਾਫੀ ਵਿਕਸਿਤ ਵੀ ਹੋਇਆ ਇਹ ਸ਼ਹਿਰ ਅਤੇ ਗੱਲ ਕਰੀਏ ਹੋਸਪੀਟਲ ਹੋ ਗਏ ਜਿਵੇਂ ਕਿ ਅਤੇ ਰੋਡ ਢਾਂਚੇ ਹੋ ਗਏ ਠੀਕ ਹੈ ਅਤੇ ਜਿਹੜੇ ਬਿਲਡਿੰਗਾਂ ਵਗੈਰਾ ਇੱਥੇ ਪ੍ਰਮੋਟ ਕੀਤੀਆਂ ਆਉਣ ਵਾਲੇ ਟਾਈਮ 'ਚ ਅਤੇ ਇਸ ਲਈ ਸਭ ਨਾਲੋਂ ਜੇ ਗੱਲ ਕਰੀਏ ਤਾਂ ਇਸ ਦਾ ਸਰਕਾਰਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਸਰਕਾਰ ਤੋਂ ਬਾਅਦ ਦੂਜੇ ਨੰਬਰ 'ਤੇ ਜਿਹੜੇ ਉੱਥੇ ਦੇ ਰਹਿਣ ਵਾਲੇ ਲੋਕ ਨੇ ਉਨ੍ਹਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਜਿਹੜੇ ਉੱਥੋਂ ਦੇ ਲੋਕ ਨੇ ਉਹ ਉਨ੍ਹਾਂ ਦੇ ਹੱਥ ਹੁੰਦਾ ਹੈ ਕਿ ਆਪਣੇ ਸ਼ਹਿਰ ਨੂੰ ਕਿੱਦਾਂ ਦਾ ਢਾਂਚਾ ਦੇਣਾ ਹੈ ਜਾਂ ਕਿੱਦਾਂ ਦਾ ਕਰਨਾ ਹੈ ਠੀਕ ਹੈ ਅਤੇ ਉੱਥੋਂ ਦੇ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਬਾਗ ਹੈ ਅਤੇ ਉਸ ਦੇ ਵਿੱਚ ਲੋਕ ਦਿਨ ਵੇਲੇ ਵੀ ਆਉਂਦੇ ਨੇ ਸ਼ਾਮ ਵੇਲੇ ਵੀ ਆਉਂਦੇ ਨੇ ਇੱਥੇ ਐ ਉਹ ਐਕਸਰਸਾਈਜ ਵਗੈਰਾ ਕਰਦੇ ਨੇ ਠੀਕ ਹੈ ਅਤੇ ਉੱਥੇ ਆਪਾਂ ਗੱਲ ਕਰੀਏ ਤਾਂ ਰੋਪੜ ਦੇ ਵਿੱਚ ਵੂਮੈਨ ਸੈੱਲ ਵੀ ਬਣਾਇਆ ਗਿਆ ਹੈ ਜੇਕਰ ਕੋਈ ਔਰਤਾਂ ਨਾਲ ਕੋਈ ਦੁਰਵਿਵਹਾਰ ਕਰਦਾ ਹੈ ਤਾਂ ਉਸ ਦਾ ਮੌਕੇ 'ਤੇ ਹੀ ਤੁਰੰਤ ਨਿਪਟਾਰਾ ਹੋ ਜਾਂਦਾ ਹੈ